ਸਤਿ ਸ਼੍ਰੀ ਅਕਾਲ ਜੀ ਭਾਰਤ ਵਿੱਚ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦਾ ਭਾਰਤ ਵਿੱਚ ਮੌਸਮ ਹਰ ਤਰ੍ਹਾਂ ਦਾ ਹੁੰਦਾ ਹੈ ਅਤੇ ਇਹ ਦੇਸ਼ਾਂ ਦੇ ਵੱਖ ਵੱਖ ਖੇਤਰਾਂ ਵਿੱਚ ਹਰ ਹਿਸਾਬ ਨਾਲ ਵੱਖਰਾ ਹੁੰਦਾ ਜਿਵੇਂ ਕਿ ਗੱਲ ਕੀਤੀ ਜਾਵੇ ਭਾਰਤ ਦੇ ਨੋਰਥ ਪੋਲ ਸਾਈਟ ਦੇ ਜਿਹੜਾ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਇਹ ਭਾਰਤ ਦੇ ਸਭ ਤੋਂ ਉੱਤਰੀ ਦੇਸ਼ਾ ਵਿੱਚ ਅ ਜਿਹੜਾ ਸਭ ਤੋਂ ਪੀਕ ਦੇ ਤਾਂ ਕਰਕੇ ਇਹ ਜ਼ਿਆਦਾ ਠੰਡੇ ਰਹਿੰਦੇ ਹਨ ਇੱਕ ਗੱਲ ਕੀਤੀ ਜਾਵੇ ਗਰਮ ਇਲਾਕਿਆਂ ਦੀ ਜਿਹੜੇ ਸਮੁੰਦਰ ਦੇ ਕਿਨਾਰੇ 'ਤੇ ਹਨ ਜਿਨ੍ਹਾਂ ਵਿੱਚ ਇੱਕ ਗੁਜਰਾਤ ਆਉਂਦਾ ਹੈ ਅਤੇ ਇੱਕ ਆਂਧਰਾ ਪ੍ਰਦੇਸ਼ ਆਉਂਦਾ ਹੈ ਹਾਂ ਮੁੰਬਈ ਇਹ ਜਗ੍ਹਾ ਗਰਮ ਜਗ੍ਹਾ ਹੈ ਜਿਹੜੀ ਗਰਮ ਰਹਿੰਦੀ ਹੈ ਇੱਥੇ ਜ਼ਿਆਦਾਤਰ ਠੰਡ ਨਹੀਂ ਹੁੰਦੀ ਕਿਉਂਕਿ ਇੱਥੇ ਜਿਹੜਾ ਸਮੁੰਦਰੀ ਏਰੀਆ ਹੈ ਹਾਂ ਸਮੁੰਦਰੀ ਏਰੀਆ ਇਲਾਕਾ ਹੋਣ ਕਰਕੇ ਇੱਥੇ ਜ਼ਿਆਦਾ ਰੇਤ ਹੁੰਦੀ ਹੈ ਇਸ ਕਰਕੇ ਗਰਮਾਹਟ ਰਹਿੰਦੀ ਹੈ ਅਤੇ ਜੇਕਰ ਗੱਲ ਕੀਤੀ ਜਾਵੇ ਬਾਕੀ ਹੋਰ ਜਿਲ੍ਹਿਆਂ ਦੀ ਜਿਵੇਂ ਹੋ ਗਿਆ ਰਾਜਸਥਾਨ ਵਗੈਰਾ ਇਹਨਾਂ ਵਿੱਚ ਜ਼ਿਆਦਾਤਰ ਰੇਗਿਸਤਾਨ ਵਾਲਾ ਏਰੀਆ ਹੈਗਾ ਹੈ ਜ਼ਿਆਦਾ ਇੱਥੇ ਨਾ ਤਾਂ ਜ਼ਿਆਦਾ ਧੁੱਪ ਰਹਿੰਦੀ ਹੈ ਅਤੇ ਨਾ ਹੀ ਠੰਡ ਰਹਿੰਦੀ ਹੈ ਜਿਨ੍ਹਾਂ ਵਿੱਚ ਰ ਦਿਨੇ ਤਾਂ ਬਹੁਤ ਗਰਮੀ ਹੋ ਜਾਂਦੀ ਆ ਅਤੇ ਰਾਤ ਨੂੰ ਠੰਡ ਹੁੰਦੀ ਹੈ ਇਸ ਲਈ ਭਾਰਤ ਵਿੱਚ ਬਹੁਤ ਅਜਿਹੇ ਦੇ ਦੇਸ਼ਾਂ ਦੇ ਵਿੱਚ ਵੱਖ ਵੱਖ ਮੌਸਮ ਹਨ ਜਿਨ੍ਹਾਂ ਦੇ ਮੌਸਮ ਬਦਲਦੇ ਰਹਿੰਦੇ ਹਨ ਧੰਨਵਾਦ